ਹਾਂਜੀ ਮੈਂ ਰੋਜ਼ ਭੰਗੜਾ ਕਲਾਸ ਵਿੱਚ ਜਾਂਦੀ ਹਾਂ ਇਸ ਨੂੰ ਮੈਂ ਕਦੀ ਵੀ ਛੱਡ ਨਹੀਂ ਸਕਦੀ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਰਹੇਗਾ ਕਿਉਂਕਿ ਮੈਂ ਛੋਟੇ ਹੁੰਦਿਆਂ ਤੋਂ ਭੰਗੜਾ ਕਲਾਸਿਸ ਜੁਆਇਨ ਕੀਤੀਆਂ ਹੋਈਆਂ ਹਨ ਮੈਂ ਉਸ ਵਿੱਚ ਪਹਿਲੇ ਨੰਬਰ 'ਤੇ ਆਈ ਸੀ ਇਸ ਲਈ ਮੈਨੂੰ ਇਹ ਵਧੀਆ ਲੱਗਦਾ ਹੈ ਇਸ ਨੂੰ ਯਾਦ ਰੱਖਣਾ ਚਾਹੀਦਾ ਹੈ ਜੋ ਸਟੈਪ ਸਾਡੇ ਹੁੰਦੇ ਹਨ ਉਹ ਹਰ ਇੱਕ ਵਿਆਹ ਸ਼ਾਦੀ 'ਤੇ ਕੰਮ ਆਉਂਦੇ ਹਨ ਭੰਗੜੇ ਦੇ ਦੋ ਚਾਰ ਸਟੈੱਪ ਸਿੱਖ ਕੇ ਆਪਾਂ ਕਿਸੇ ਵੀ ਵਿਆਹ 'ਤੇ ਕਰ ਸਕਦੇ ਹਾਂ ਇਸ ਲਈ ਭੰਗੜੇ ਨਾਲ ਸਾਡੀ ਕਸਰਤ ਵੀ ਹੁੰਦੀ ਹੈ ਭੰਗੜਾ ਇੱਕ ਯਾਦਗਾਰ ਹੁੰਦਾ ਹੈ ਭੰਗੜਾ ਸਾਨੂੰ ਆਪਣੇ ਸਰੀਰ ਲਈ ਜ਼ਰੂਰ ਕਰਨਾ ਚਾਹੀਦਾ

ਭੰਗੜੇ ਨਾਲ ਸਾਡੇ ਸਰੀਰ ਦੀ ਕਸਰਤ ਵੀ ਹੁੰਦੀ ਹੈ ਜਿੱਦਾਂ ਜਿਸ ਵਿਆਹ 'ਤੇ ਕਰ ਲਈਏ ਉੱਥੇ ਵੀਡੀਓ ਬਣਦੀ ਹੈ ਸਾਰੀ ਜ਼ਿੰਦਗੀ ਦੀ ਉਹ ਯਾਦਗਾਰ ਰਹਿ ਜਾਂਦੀ ਹੈ ਇਸ ਲਈ ਸਾਨੂੰ ਕਿਸੇ ਦੇ ਵਿਆਹ 'ਤੇ ਖੁਸ਼ ਹੋ ਕੇ ਖੁੱਲ੍ਹੇਆਮ ਭੰਗੜਾ ਦਿਲ ਖੋਲ੍ਹ ਕੇ ਕਰਨਾ ਚਾਹੀਦਾ ਹੈ